ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕੋਵਿਡ ਨਾਈਨਟੀਨ ਸੈਂਟਰ ਬਰਨਾਲਾ ਤੋਂ ਗੱਲ ਕਰ ਰਹੇ ਹੋ ਅੱਛਾ ਹਾਂਜੀ ਮੈਂ ਨਾ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਗਾ ਜੀ ਹਾਂਜੀ ਉਹ ਮੇਰੇ ਨਾ ਵੱਡੇ ਭਾਈ ਸਾਹਿਬ ਆ ਉਹਨਾਂ ਦੀ ਉਮਰ ਹੈਗੀ ਆ ਬਾਹਠ ਕੁ ਸਾਲ ਦੀ ਹੈ ਜੀ ਕਈ ਦਿਨਾਂ ਤੋਂ ਉਹਨਾਂ ਨੂੰ ਬੁਖਾਰ ਚੱਲ ਰਿਹਾ ਹੈਗਾ ਹਲਕਾ ਜਿਹਾ ਬੁਖਾਰ ਹੱਡ ਪੈਰ ਉਹਨਾਂ ਦੇ ਟੁੱਟਦੇ ਹੈਗੇ ਖਾਂਸੀ ਵੀ ਹੈਗੀ ਆ ਹਲਕੀ ਜਿਹੀ ਅਤੇ ਸਾਹ ਵੀ ਉਹਨਾਂ ਦਾ ਫੁੱਲਿਆ ਰਹਿੰਦਾ ਗਾ ਅਤੇ ਦੇਖੋ ਉਹਨਾਂ ਦਾ ਮੈਂ ਪਿੰਡੋਂ ਵੀ ਦਵਾਈ ਦਵਾਈ ਹੈ ਦੋ ਤਿੰਨ ਵਾਰ ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਮੈਂ ਸੀ ਬੀ ਸੀ ਟੈਸਟ ਵੀ ਕਰਵਾਇਆ ਹੈਗਾ ਸਮਝ ਜਿਹੀ ਨਹੀਂ ਆਉਂਦੀ ਵੀ ਕੀ ਕੁਝ ਹੋ ਰਿਹਾ ਗਾ ਅਤੇ ਕਈ ਹੁਣ ਊਂ ਵੀ ਵੈਸੇ ਤਾਂ ਉਹਨਾਂ ਨੂੰ ਮੈਂ ਅ ਅੱਡ ਹੀ ਰੱਖਿਆ ਹੋਇਆ ਮੈਨੂੰ ਪਤਾ ਗਾ ਵੀ ਕਰੋਨਾ ਵਾਲਾ ਜਿਹੜਾ ਮਾਹੌਲ ਜਿਹਾ ਹੈਗਾ ਉਹ ਚੱਲ ਰਿਹਾ ਗਾ ਹਨਾ ਕੋਵਿਡ ਨਾਈਨਟੀਨ ਦੇ ਉਹਨਾਂ ਦੇ ਟੀਕੇ ਹਜੇ ਨਹੀਂ ਲਗਵਾਇਆ ਨਹੀਂ ਗਾ ਅਸੀਂ ਅਤੇ ਵੈਸੇ ਨਾ ਮੈਨੂੰ ਤੁਸੀਂ ਗਾਈਡ ਜ਼ਰੂਰ ਕਰੋ ਵੀ ਜਿਹੜਾ ਇਹਦਾ ਟੈਸਟ ਇਹਦਾ ਮੈਂ ਕਿੱਥੋਂ ਕਰਾਂਵਾ ਦੇਖੋ ਬਰਨਾਲੇ ਜੋ ਤੁਹਾਡੇ ਹੋ ਕੇਂਦਰ ਜਿਹੜਾ ਤੁਸੀਂ ਇਹ ਸਥਾਪਤ ਕੀਤਾ ਵਿਆ ਹੈ ਇੱਥੇ ਹੋਜੂਗਾ ਜਾਂ ਮੈਂ ਆਮ ਲਬੋਟਰੀ ਦੇ ਵਿੱਚੋਂ ਕਰਵਾ ਕੇ ਲੈ ਕੇ ਆਵਾਂ ਠੀਕ ਹੈ ਉਹ ਤੇ ਊਂ ਨਾ ਇਹਨੂੰ ਮੈਂ ਸੈਨੀਟਾਈਜ਼ਰ ਵਗੈਰਾ ਅਸੀਂ ਯੂਜ ਕਰ ਰਹੇ ਹੈ ਭਾਈ ਸਾਹਿਬ ਨਾ ਅੱਡ ਕਮਰੇ ਦੇ ਵਿੱਚ ਹੀ ਰੱਖੇ ਹੋਏ ਨੇ ਸਾਡਾ ਪੂਰੇ ਪਰਿਵਾਰ ਨੇ ਅਸੀਂ ਵੀ ਆਪਣਾ ਧਿਆਨ ਰੱਖਿਆ ਹੋਇਆ ਹੈਗਾ ਫਿਲਹਾਲ ਐਂ ਆ ਨਾ ਵੀ ਡਰ ਜਿਹਾ ਲੱਗਦਾ ਹੈਗਾ ਵੀ ਕਿਤੇ ਹੋਵੇ ਨਾ ਚਲੋ ਪਰਮਾਤਮਾ ਕਰੇ ਨਾ ਹੀ ਹੋਵੇ ਤਾਂ ਇੱਕ ਤਾਂ ਮੈਨੂੰ ਤੁਸੀਂ ਇਹ ਦੱਸੋ ਵੀ ਇਹਨਾਂ ਦੀ ਮੈਂ ਟੈਸਟਿੰਗ ਕਿੱਥੇ ਕਰਵਾ ਕੇ ਆਵਾਂ ਠੀਕ ਆ ਜੀ ਜੇ ਚਲੋ ਟੈਸਟਿੰਗ ਵੀ ਹੋਜੂ ਕਿ ਇਹਨਾਂ ਦੀ ਉਮਰ ਬਾਹਠ ਸਾਲ ਦੀ ਹੈ ਕੋਈ ਜਿਹੜੀ ਡੋਜ਼ ਵਗੈਰਾ ਇਹਦੀ ਕੋਵੈਕਸੀਨ ਲੱਗ ਰਹੀ ਇਹਨਾਂ ਦੀ ਕਰੋਨਾ ਦੀ ਕੀ ਇਹਨਾਂ ਦੇ ਲੱਗੂਗੀ ਜਾਂ ਨਹੀਂ ਲੱਗੂਗੀ ਕਿਰਪਾ ਕਰਕੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੱਸੋ ਅਤੇ ਇਹ ਟੈਸਟ ਵਾਲਾ ਮੈਨੂੰ ਜ਼ਰੂਰ ਦੱਸ ਦਿਓ ਕੀ ਮੈਂ ਲੋਕਲ ਲਬੋਟਰੀ ਤੋਂ ਕਰਵਾ ਲਵਾਂ ਇੱਥੇ ਜਾਂ ਤੁਹਾਡੇ ਹੀ ਇੱਥੇ ਲੈ ਕੇ ਆਵਾਂ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡੇ ਕੋਲ ਲੈ ਕੇ ਆ ਰਿਹਾ ਹੈਗਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ